ਕੀ ਤੁਸੀਂ ਸਕੂਲ ਵਿੱਚ ਚਿੱਤਰਕਾਰੀ ਸਿੱਖੀ ਸੀ ਕੀ ਤੁਸੀਂ ਚੰਗੇ ਕੋਰਸ ਬਾਰੇ ਜਾਣਦੇ ਹੋ ਜੋ ਕਲਾਕਾਰੀ ਵ ਦੀ ਮਦਦ ਕਰੇਗੀ ਕੀ ਤੁਸੀਂ ਆਪਣੇ ਕੋਲ ਕਲਾ ਕੇਰੀਅਰ ਲਈ ਕੋਈ ਟੀਚਾ ਜਾਂ ਇੱਛਾਵਾਂ ਹਨ ਤੁਸੀਂ ਪ੍ਰੋਪਰ ਕਰਨ ਦੀ ਯੋਜਨਾ ਕਿਵੇਂ ਬਣਾਉਂਦੇ ਹੋ ਮੈਂ ਕਾਲਜ ਵਿੱਚ ਆਟੋਕੈਡ ਦੀ ਟ੍ਰੇਨਿੰਗ ਕੀਤੀ ਸੀ ਜੋ ਕਿ ਬਹੁਤ ਹੀ ਫ਼ਾਇਦੇਮੰਦ ਅਤੇ ਫ਼ਾਇਦੇਮੰਦ ਹੈ ਜੋ ਕਲਾਕਾਰੀ ਦੀ ਮਦਦ ਕਰਦੀ ਹੈ ਜਿਵੇਂ ਕਿ ਕੋਈ ਵੀ ਚੀਜ਼ ਦੀ ਕੰਪੋਨੈਂਟ ਦੀ ਅਸੀਂ ਡਿਜ਼ਾਇਨ ਬਣਾਉਂਦੇ ਹਾਂ ਤਾਂ ਉਹ ਆਟੋਕੈਡ ਦੇ ਵਿੱਚ ਬਣਾਇਆ ਜਾਂਦਾ ਹੈ ਜੋ ਕਿ ਆਟੋਕੈਡ ਦੇ ਵਿੱਚ ਬਣਾਉਣ ਤੋਂ ਬਾਅਦ ਉਸਨੂੰ ਪ੍ਰੈਕਟੀਕਲ ਕਰਕੇ ਦੇਖਿਆ ਜਾਂਦਾ ਹੈ ਜੋ ਕਿ ਬਹੁਤ ਫ਼ਾਇਦੇਮੰਦ ਹੈ ਜਿਸ ਨਾਲ ਕੋਈ ਵੀ ਕੰਪੋਨੈਂਟ ਕਦੇ ਗਲਤ ਨਹੀਂ ਬਣ ਸਕਦਾ ਅਸੀਂ ਉਸ ਕੰਪੋਨੈਂਟ ਨੂੰ ਬਣਾ ਕੇ ਚਲਾ ਕੇ ਵੀ ਉਸ ਐਪ ਦੇ ਵਿੱਚ ਚੈੱਕ ਕਰ ਸਕਦੇ ਹਾਂ ਆਟੋਕੈਡ ਬਹੁਤ ਹੀ ਫ਼ਾਇਦੇਮੰਦ ਚੀਜ਼ ਹੈ ਅਸੀਂ ਇਹ ਇੱਕ ਤਰ੍ਹਾਂ ਦੀ ਮਕੈਨੀਕਲ ਡਰਾਇੰਗ ਦੀ ਯੂਜ ਵਿੱਚ ਆਉਂਦੀ ਹੈ ਜੋ ਕਿ ਬਹੁਤ ਹੀ ਬੈ ਮਕੈਨੀਕਲ ਲਾਈਨ ਦੇ ਵਿੱਚ ਬਹੁਤ ਹੀ ਬੈਨੀਫਿਟ ਕਰਦੀ ਹੈ ਆਟੋਕੈਡ ਦੇ ਵਿੱਚ ਅਸੀਂ ਸਾਰੇ ਕਪੋਨੈਂਟ ਹਰੇਕ ਪਾਸੇ ਘੁੰਮਾ ਕੇ ਚੈੱਕ ਕਰਕੇ ਇਹ ਦੱਸਣ ਤਸੱਲੀ ਨਾਲ ਦੇਖ ਸਕਦੇ ਹਾਂ